ਮੈਂ ਸਿਲਾਈ ਟੀਚਰ ਵੀ ਹਾਂ ਸਿਲਾਈ ਵੀ ਕਰਦੀ ਹਾਂ ਅਤੇ ਦੂਜੀ ਗੱਲ ਮੈਂ ਸਵੈਟਰ ਬੁਣਦੀ ਵੀ ਹਾਂ ਉੱਨ ਦੇ ਜਿਹੜੇ ਕੀ ਮੇਰੇ ਬੱਚਿਆਂ ਨੂੰ ਬਹੁਤ ਪਸੰਦ ਨੇ ਉਹ ਖੁਸ਼ ਹੋ ਕੇ ਪਹਿਨਦੇ ਨੇ ਕਿਉੰਕਿ ਅੱਜਕਲ ਸਵੈਟਰ ਜੋ ਬਜ਼ਾਰ ਵਿੱਚ ਮਿਲਦੇ ਨੇ ਉਹ ਰੇਡੀਮੇਟ ਨੇ ਹੱਥ ਦੇ ਬੁਣੇ ਹੋਏ ਸਵੈਟਰ ਕਿਤੇ ਵੀ ਨਹੀਂ ਮਿਲਦੇ ਕਿਉਂਕਿ ਇਹ ਹੱਥ ਦਾ ਕੰਮ ਕਿਸੇ ਕੋਲ ਵੀ ਅੱਜਕਲ ਦੇ ਬੱਚੇ ਤਾਂ ਬਿਲਕੁਲ ਨਹੀਂ ਕਰ ਰਹੇ ਪੁਰਾਣੇ ਪੁਰਾਣੇ ਮੈਂਬਰ ਕਰਦੇ ਸੀ ਅੱਜ ਵੀ ਕਰਦੇ ਨੇ ਅਤੇ ਉਹਨਾਂ ਦੇ ਵਿੱਚ ਮੈਂ ਅਲੱਗ ਅਲੱਗ ਤਰ੍ਹਾਂ ਦੇ ਡਿਜ਼ਾਈਨ ਤਿਆਰ ਕਰਦੀ ਹਾਂ ਜੋ ਕੇ ਇਹਨਾਂ ਨੂੰ ਬਹੁਤ ਪਸੰਦ ਆਉਂਦੇ ਮੇਰੇ ਬੱਚਿਆਂ ਨੂੰ ਬਹੁਤ ਸਵੈਟਰ ਮੈਂ ਇਹਨਾਂ ਦੇ ਬਣਾ ਬਣਾ ਕੇ ਰੱਖੇ ਹੋਏ ਨੇ ਇਹ ਖੁਸ਼ ਹੋ ਕੇ ਪਹਿਨਦੇ ਨੇ